ਬਾਈ ਜੁਲਾਈ ਉੱਨੀ ਸੌ ਇਕਾਨਵੇਂ ਤੀਹ ਜਨਵਰੀ ਦੋ ਹਜ਼ਾਰ ਤੇਈ ਚਾਰ ਮਾਰਚ ਦੋ ਹਜ਼ਾਰ ਤੇਈ ਬਾਈ ਜੁਲਾਈ ਦੋ ਹਜ਼ਾਰ ਤੇਈ ਚੌਦਾਂ ਦਸੰਬਰ ਦੋ ਹਜ਼ਾਰ ਇੱਕੀ